ਮੇਰਾ ਜਿਹੜਾ ਨੈਗੇਟਿਵ ਐਕਸਪੀਰੀਅੰਸ ਰਿਹਾ ਆ ਮੈਂ ਨਾ ਆਨਲਾਈਨ ਵੈਬਸਾਈਟ ਇੱਕ ਚੈੱਕ ਕਰ ਰਹੀ ਸੀ ਉੱਥੇ ਮੀਸ਼ੋ ਦੇ ਵਿੱਚੋਂ ਮੈਂ ਕੈਮਰਾ ਮੰਗਾਇਆ ਸੀ ਤੇ ਉਹਨਾਂ ਨੇ ਜਿਹੜੀਆਂ ਫੋਟੋਆਂ ਪਾਈਆਂ ਹੋਈਆਂ ਸੀ ਉਤੇ ਬਹੁਤ ਸੋਹਣੀਆਂ ਸੋਹਣੀਆ ਪਾਈਆਂ ਹੋਈਆਂ ਸੀ ਟਵੰਟੀ ਏਟ ਟਵੰਟੀ ਫਾਈਵ ਮੈਗਾ ਪਿਕਸਲ ਵੱਡੇ ਜਿਹੜੇ ਕੈਮਰੇ ਹੁੰਦੇ ਆ ਉਹ ਸੀਗਾ ਉਹਨਾਂ ਦੇ ਲੈਂਸ ਸੀਗੇ ਲੈਂਸ ਕਵਰ ਸੀਗੇ ਫਿਰ ਕੈਮਰੇ ਦਾ ਕਵਰ ਸੀ ਕੈਮਰੇ ਦਾ ਸਟੈਂਡ ਸੀ ਕੈਮਰੇ ਨੂੰ ਸਾਰਾ ਕੁਝ ਸੀਗਾ ਕੈਮਰੇ ਦਾ ਤੇ ਉਹਨਾਂ ਨੇ ਫੋਟੋ ਪਾਈਆਂ ਹੋਈਆਂ ਸੀ ਮੈਂ ਉਹਨਾਂ ਨੂੰ ਪਹਿਲਾਂ ਪੰਦਰਾਂ ਹਜ਼ਾਰ ਰੁਪਇਆ ਕਰਦਾ ਸੀਗਾ ਆਨਲਾਈਨ ਪੇਅ ਕਰਦਾ ਸੀ ਠੀਕ ਐ ਬਾਕੀ ਪ੍ਰੋਡਕਟ ਜਦੋਂ ਆਇਆ ਮੇਰੇ ਘਰੇ ਮੈਂ ਆਨਲਾਈਨ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਹਾਫ ਜਿਹੜਾ ਵਾ ਪਹਿਲਾਂ ਕਰਨਾ ਹਾਫ ਬਾਦ ਚ ਕਰਨਾ ਮੈਂ ਬਾਅਦ ਦੇ ਵਿੱਚ ਪੰਦਰਾਂ ਹਜ਼ਾਰ ਹੋਰ ਜਦੋਂ ਉਹਨਾਂ ਨੇ ਓ ਟੀ ਪੀ ਲੈਣਾ ਸੀਗਾ ਤੇ ਉਹ ਮੈਨੂੰ ਉਹਨਾਂ ਨੇ ਪੰਦਰਾਂ ਹਜ਼ਾਰ ਰੁਪਇਆ ਉਹਨਾਂ ਨੇ ਲੈ ਲਿਆ ਮੇਰੇ ਤੋਂ ਹੋਰ ਜਦੋਂ ਮੈਨੂੰ ਡਿਲੀਵਰੀ ਕਰਨ ਆਏ ਉਹ ਪ੍ਰੋਡਕਟ ਨੂੰ ਤੇ ਮੈਂ ਉਹ ਪੰਦਰਾਂ ਹਜ਼ਾਰ ਰੁਪਇਆ ਹੋਰ ਉਹਨਾਂ ਨੂੰ ਦੇ ਦਿੱਤਾ ਤੇ ਬਾਅਦ ਜਦੋਂ ਡਿਲੀਵਰੀ ਵਾਲਾ ਚਲਾ ਗਿਆ ਓ ਟੀ ਪੀ ਲੈ ਕੇ ਤੇ ਉਹਦੇ ਵਿੱਚੋਂ ਕੈਮਰੇ ਦੀ ਜਗ੍ਹਾ ਨਕਲੀ ਨਕਲੀ ਛੋਟਾ ਟੁਆਏ ਕੈਮਰਾ ਨਿਕਲਿਆ ਆ ਜਿਹੜਾ ਪੰਜ ਛੇ ਸੋ ਰੁਪਏ ਦਾ ਹੋਏਗਾ ਤੇ ਮੈਨੂੰ ਘਰੋਂ ਗਾਲਾਂ ਵੀ ਪਈਆਂ ਮੈਨੂੰ ਇਹ ਰਿਵਿਊ ਇਨਾ ਗੰਦਾ ਲੱਗਿਆ ਨੈਗਟਿਵ ਲੱਗਿਆ ਮੰਗਾਇਆ ਕੁਝ ਹੋਰ ਤੇ ਆਇਆ ਕੁਝ ਹੋਰ